ਹਾਂਜੀ ਹੈਲੋ ਹਰਦੀਪ ਸਿੰਘ ਬੋਲਦੇ ਜੀ ਸਤਿ ਸ਼੍ਰੀ ਅਕਾਲ ਜੀ ਜਗਦੀਪ ਸਿੰਘ ਬੋਲਦਾ ਜੀ ਬੰਬੇ ਤੋਂ ਹਾਂ ਮੈਨੂੰ ਨਾ ਤੁਹਾਡਾ ਨੰਬਰ ਮੇਰਾ ਇੱਕ ਦੋਸਤ ਹੈ ਬੂਟਾ ਸਿੰਘ ਉਹ ਤੁਹਾਡੇ ਵੀ ਇੱਥੇ ਗੁਆਂਢੀ ਹੈ ਸੁਰਜੀਤ ਸਿੰਘ ਉਹਨਾਂ ਦੇ ਦੋਸਤ ਹੈ ਅਤੇ ਸ਼ਾਇਦ ਤੁਸੀਂ ਵੀ ਉਹਨਾਂ ਨੂੰ ਮਿਲੇ ਹੋਊਂਗੇ ਬੂਟਾ ਸਿੰਘ ਨੂੰ ਹਾਂਜੀ ਹਾਂਜੀ ਹਾਂਜੀ ਉਹਨਾਂ ਨੇ ਨੰਬਰ ਤੁਹਾਡਾ ਦਿੱਤਾ ਸੀਗਾ ਅਤੇ ਮੈਂ ਨਾ ਨੈਕਸਟ ਯੀਅਰ ਮਾਰਚ ਦੇ ਵਿੱਚ ਇੱਥੇ ਪੰਜਾਬ ਦੇ ਵਿੱਚ ਆਉਣਾ ਚਾਹੁੰਦਾ ਹਾਂ ਸਰ ਮੈਨੂੰ ਇੱਕ ਦੱਸੋ ਵੀ ਇੱਥੇ ਜਿਹੜਾ ਕਲੇਮਟ ਹੈਗਾ ਉਹ ਕਿੱਦਾਂ ਦਾ ਹੈਗਾ ਆ ਅੱਛਾ ਅੱਛਾ ਠੀਕ ਹੈ ਜੀ ਹੁਣ ਹੁਣ ਇੱਥੇ ਕਿੱਦਾਂ ਦਾ ਮੌਸਮ ਹੈ ਜੀ ਪੰਜਾਬ ਵਿੱਚ ਅੱਛਾ ਅੱਛਾ ਇਹ ਇਹ ਹੁਣ ਤਾਂ ਇੱਥੇ ਮ ਬੰਬੇ ਵਿੱਚ ਪੂਰਾ ਮੀਂਹ ਪੈ ਰਿਹਾ ਇੱਥੇ ਜਾਣੀ ਕਿ ਠੰਡ ਹੈ ਹੈ ਨਾ ਜੀ

ਜਾਣੀ ਕਿ ਮਾਰਚ ਮਹੀਨੇ ਵਿੱਚ ਪੰਜਾਬ ਦੇ ਵਿੱਚ ਮੌਸਮ ਵਧੀਆ ਹੈ ਘੁੰਮਣ ਲਈ ਠੀਕ ਹੈ ਜੀ ਧੰਨਵਾਦ ਆਪਾਂ ਮਿਲਾਂਗੇ ਜੀ ਜ਼ਰੂਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਜ਼ਰੂਰ ਜੀ ਸਤਿ ਸ਼੍ਰੀ ਅਕਾਲ ਜੀ